ਸਤਿ ਸ਼੍ਰੀ ਅਕਾਲ ਜੀ ਭਾਅ ਜੀ ਹੋਰ ਸੁਣਾਓ ਕੀ ਹਾਲ ਚਾਲ ਜੇ ਬਸ ਸਾਡਾ ਵੀ ਵਧੀਆ ਭਾਅ ਜੀ ਉਹ ਲੱਭਦੇ ਨਹੀਂ ਉਹ ਗੱਲ ਇੱਦਾਂ ਭਾਅ ਜੀ ਕਿ ਬਸ ਪ੍ਰਮੋਸ਼ਨ ਹੋ ਗਈ ਹੈ ਇੱਧਰ ਉੱਧਰ ਫਿਰ ਜਾਣਾ ਪੈਂਦਾ ਤੁਹਾਨੂੰ ਪਤਾ ਹੀ ਹੈ ਫਿਰ ਦੂਸਰੇ ਬੰਨੇ ਹੁਣ ਕਰ ਦਿੱਤੀ ਹੈ ਇੱਥੋਂ ਸ਼ਿਫਟ ਹਟਾ ਦਿੱਤੀ ਸਾਡੀ ਅਤੇ ਫਿਰ ਦੂਸਰੇ ਬੰਨੇ ਕਰਤੀ ਹਾਂਜੀ ਉਹ ਭਾਅ ਜੀ ਮੈਂ ਤੁਹਾਡੇ ਤੋਂ ਨਾ ਹੈਡਫੋਨ ਲੈ ਕੇ ਗਿਆ ਸੀ ਨਾ ਇਹਨਾਂ 'ਚੋਂ ਕਦੀ ਆਵਾਜ਼ ਆਉਂਦੀ ਤੁਸੀਂ ਕਹਿੰਦੇ ਬੜੇ ਵਧੀਆ ਹੈ ਅਤੇ ਇਹਨਾਂ 'ਚ ਤਾਂ ਆਵਾਜ਼ ਨਹੀਂ ਆਉਂਦੀ ਵੀ ਕਦੀ ਆਵਾਜ਼ ਆਉਂਦੀ ਇੱਕ 'ਚੋਂ ਕਦੀ ਵੀ ਆਉਂਦੀ ਹੈ ਤਾਂ ਕਿਸੇ ਦੂਸਰੇ 'ਚ ਆਉਂਦੀ ਨਹੀਂ ਕਦੀ ਦੂਸਰੇ 'ਚ ਆਉਂਦੀ ਪਹਿਲੇ 'ਚੋਂ ਨਹੀਂ ਆਉਂਦੀ ਹਾਂਜੀ ਭਾਅ ਜੀ ਇਹ ਪਤਾ ਨਹੀਂ ਕੀ ਹਿਸਾਬ ਦਾ ਆ ਤੁਸੀਂ ਕਹਿੰਦੇ ਤੇ ਬੜੇ ਵਧੀਆ ਇੱਦਾਂ ਇਹ ਕੰਪਨੀ ਦੇ ਇਹ ਬ੍ਰਾਂਡ ਦੇ ਆ ਇੱਧਰੋਂ ਆਏ ਦੇ ਆ ਇਹਨੇ ਸਪੋਂਸਰ ਕੀਤੇ ਵੇ ਆ ਹਾਂਜੀ ਭਾਅ ਜੀ ਕਿ ਮਤਲਬ ਹੁਣ ਮੈਂ ਨਾ ਚਾਹੁੰਦਾ ਕਿ ਜਾਂ ਤੁਸੀਂ ਮੈਨੂੰ ਦੂਸਰੇ ਦੂਸਰੇ ਦਿਖਾ ਦਿਓ ਹਾਂਜੀ ਜਾਂ ਤਾਂ ਤੁਸੀਂ ਇਹਦਾ ਫੋਲਟ ਚੈੱਕ ਕਰ ਲਓ ਕਿ ਬਈ ਕੀ ਕੀ ਗੱਲ ਆ ਕਿ ਮਤਲਬ ਇਹਨੂੰ ਪ੍ਰੋਬਲਮ ਕੀ ਹੈ ਕਿ ਕਿਹੜੀ ਜਿਹਦੇ ਕਰਕੇ ਕਦੀ ਅੜਦੇ ਆ ਕਦੀ ਆਵਾਜ਼ ਕਦੀ ਦੂਰ ਜਾਵਾਂ ਤਾਂ ਬਿਲਕੁਲ ਹੀ ਉਹ ਹੋ ਜਾਂਦੀ ਖ਼ਰਾਬ ਹਾਂਜੀ ਪਤਾ ਨਹੀਂ ਕੀ ਚੱਕਰ ਹੈ ਹੈ ਭਾਅ ਜੀ ਬਾਕੀ ਤੁਸੀਂ ਚੈੱਕ ਕਰ ਦਿਓ ਹੋਰ ਕੋਈ ਗੱਲ ਨਹੀਂ ਹੈ ਬਾਕੀ ਠੀਕ ਚੱਲਦੇ ਆ ਇੱਦਾਂ ਦੀ ਗੱਲ ਨਹੀਂ ਪਰ ਵਿੱਚ ਜੀਅ ਨਾ ਇੱਕ ਪ੍ਰੋਬਲਮ ਆ ਜਾਂਦੀ ਆ ਕਦੀ ਇਹਦੇ ਵਿੱਚ ਆਵਾਜ਼ ਖੜ ਖੜ ਕਰਨੀ ਸ਼ੁਰੂ ਹੋ ਜਾਂਦੀ ਹੈ ਜਾਂ ਆਵਾਜ਼ ਬੜੀ ਤਿੱਖੀ ਪੈਂਦੀ ਆ ਜੇ ਸਿਰ ਨੂੰ ਸਿਰ ਨੂੰ ਚੜਨ ਲੱਗ ਪੈਂਦੀ ਆ ਸਿਰ ਵੀ ਪੀੜ ਕਰਨ ਲੱਗ ਪੈਂਦਾ ਭਾਅ ਜੀ ਇਹਦੇ ਨਾਲ ਫਿਰ ਹਾਂਜੀ ਆਹੋ ਪਤਾ ਨਹੀਂ ਇਹਦੇ ਹੈਡਫੋਨਾਂ ਦੇ ਸਪੀ ਪਤਾ ਨਹੀਂ ਸਪੀਕਰਾਂ 'ਚ ਪ੍ਰੋਬਲਮ ਆ ਕਦੀ ਖਰ ਖਰ ਕਰਦੇ ਆ ਅਤੇ ਕਦੀ ਜਾਂ ਤਾਂ ਇੱਕ 'ਚੋਂ ਆਊਗੀ ਆਵਾਜ਼ ਦੂਸਰੇ 'ਚ ਆਉਣੀ ਨਹੀਂ ਆ ਹਾਂਜੀ ਤੁਸੀਂ ਵੇਖੋ ਭਲਾ ਕੀ ਹਿਸਾਬ ਕਿਤਾਬ ਕੀ ਆ ਇਹਨਾਂ ਹੈਡਫੋਨਾਂ ਦਾ ਹਾਂਜੀ ਭਲਾ ਚੈੱਕ ਕਰਿਓ ਭਲਾ ਇਹਦੇ ਸਪੀਕਰ ਧਿਆਨ ਨਾਲ ਚੈੱਕ